ਜੇਕਰ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਆਪਣੇ ਤਜਰਬੇ ਦੀ ਗੱਲ ਕਰਾਂ ਤਾਂ ਮੈਨੂੰ ਪੜ੍ਹਣਾ ਪੜ੍ਹਨ ਦਾ ਬਹੁਤ ਸਾਰਾ ਸ਼ੌਂਕ ਹੈ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਿਤਾਬਾਂ ਸ਼ਾਮਿਲ ਹਨ ਇਹਨਾਂ ਕਿਤਾਬਾਂ ਵਿੱਚੋਂ ਸਭ ਤੋਂ ਜ਼ਿਆਦਾ ਹਿਸਟਰੀ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਜਿਸ ਨੂੰ ਕਿ ਮੈਂ ਆਪਣੇ ਇਹ ਪਸੰਦੀਦੀ ਜੀਵਨ ਸ਼ੈਲੀ ਵੀ ਕਹਿ ਸਕਦੀ ਹਾਂ ਕਿ ਹਿਸਟਰੀ ਇੱਕ ਅਜਿਹਾ ਸਬਜੈਕਟ ਹੈ ਜਿਸ ਵਿੱਚ ਪੰਜਾਬ ਭਾਰਤ ਇੰਡੀਆ ਸਭ ਦਾ ਇਤਿਹਾਸ ਸ਼ਾਮਿਲ ਹੁੰਦਾ ਹੈ ਹਿਸਟਰੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਨੂੰ ਹਿਸਟਰੀ ਹੀ ਸਭ ਤੋਂ ਜ਼ਿਆਦਾ ਪਸੰਦ ਹੈ ਜਦ ਕਿ ਮੈਂ ਗ੍ਰੈਜੂਏਸ਼ਨ ਵੀ ਹਿਸਟਰੀ 'ਚ ਹੀ ਕਰੀ ਹੈ ਹਿਸਟਰੀ ਵਿੱਚ ਗੁਰੂਆਂ ਪੀਰੀਆਂ ਪੀਰਾਂ ਮਹਾਰਾਜਿਆਂ ਰਾਜਿਆਂ ਦੀਆਂ ਕਹਾਣੀਆਂ ਜੰਗਾਂ ਸਭ ਦਾ ਜ਼ਿਕਰ ਕੀਤਾ ਗਿਆ ਅਤੇ ਹਿਸਟਰੀ ਦੀ ਗੱਲ ਕਰੀਏ ਤਾਂ ਹਿਸਟਰੀ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਗੱਲਾਂ ਇਹ ਗੁਰੂ ਨਾਨਕ ਦੇਵ ਜੀ ਦੀ ਜੀਵਨ ਤੋਂ ਸਿੱਖਣ ਨੂੰ ਮਿਲਦੀਆਂ ਨੇ ਜੋ ਕਿ ਸਾਨੂੰ ਸਹੀ ਰਸਤੇ 'ਤੇ ਪਹੁੰਚਾਉਣ 'ਚ ਸਾਡੇ ਨਾਲ਼ ਸਹਾਈ ਹੁੰਦੀਆਂ ਨੇ ਦੂਜੀ ਗੱਲ ਕਰੀਏ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਂ ਜੰਗ ਯੁੱਧ ਕੀਤੇ ਆਪਣੇ ਧਰਮ ਨੂੰ ਆਪਣੀ ਸਿੱਖੀ ਧਰਮ ਨੂੰ ਬਚਾਉਣ ਲਈ ਜੋ ਕਿ ਇਹ ਸਾਰਾ ਹਿਸਟਰੀ ਵਿੱਚ ਹੀ ਸ਼ਾਮਿਲ ਕੀਤਾ ਜਾਂਦਾ ਹੈ ਕੈ ਜੇਕਰ ਗੱਲ ਕਰੀਏ ਰਾਜਿਆਂ ਮਹਾਰਾਜਿਆਂ ਦੀ ਤਾਂ ਉਹਨਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਇੱਕ ਸੀ ਜਿਨ੍ਹਾਂ ਨੇ ਭਾਰਤ ਲਈ ਬਹੁਤ ਸਾਰੀਆਂ ਜੰਗਾਂ ਕੀਤੀਆਂ ਅਤੇ ਯੁੱਧ ਕੀਤੇ ਜਿਨ੍ਹਾਂ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਹਿਸਟਰੀ ਵਿੱਚ ਇੱਕ ਅਲੱਗ ਹੀ ਨਾਮ ਹੈ ਉਹਨਾਂ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਮਹਾਰਾਜਾ ਦਲੀਪ ਸਿੰਘ ਦੀ ਹਿਸਟਰੀ ਵੀ ਇੱਕ ਸਭ ਤੋਂ ਅਲੱਗ ਹੈ ਕਿਉਂ ਮੈਨੂੰ ਹਿਸਟਰੀ ਪੜ੍ਹਨ 'ਚ ਮੇਰਾ ਅਲੱਗ ਹੀ ਸ਼ੌਂਕ ਹੈ ਅਲੱਗ ਹੀ ਤਜਰਬਾ ਹੈ ਕਹਿ ਅਤੇ ਮੈਂ ਅਲੱਗ ਮੈਂ ਹਰ ਚੀਜ਼ ਚਾਹੁੰਦੀ ਐਂ ਕਿ ਮੈਂ ਹ ਹਰ ਇਤਿਹਾਸ ਨੂੰ ਮਤਲਬ ਪੜ੍ਹਾਂ ਅਲੱਗ ਅਲੱਗ ਚੀਜ਼ਾਂ ਉਹਨਾਂ ਤੋਂ ਸਿੱਖਾਂ ਜੇਕਰ ਮੈਂ ਆਪਣੀ ਗੱਲ ਕਰਾਂ ਆਪਣੇ ਘਰ ਦੇ ਤਜਰਬੇ ਦੀ ਗੱਲ ਕਰਾਂ ਤਾਂ ਮੈਨੂੰ ਹਮੇਸ਼ਾ ਮੇਰੇ ਹਸਬੈਂਡ ਹਿਸਟਰੀ ਦੀਆਂ ਬੁੱਕਸ ਹੀ ਗਿਫ਼ਟ ਕਰਦੇ ਨੇ ਜਿਹੜੀਆਂ ਕਿ ਮੈਂ ਪੜ੍ਹਣਾ ਬਹੁਤ ਪਸੰਦ ਕਰਦੀ ਹਾਂ ਮੇਰੇ ਨੇੜੇ ਤੇੜੇ ਦੇ ਲੋਕ ਵੀ ਮੇਰੇ ਨਾਲ ਬਹੁਤ ਕੁਝ ਮੈਨੂੰ ਕਿਸੇ ਤੋਂ ਹਿਸਟਰੀ ਸਿੱਖਣੀ ਜਾਂ ਹਿਸਟਰੀ ਪੁੱਛਣੀ ਹਿਸਟਰੀ ਦੀਆਂ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਪਸੰਦ ਨੇ ਕਿਉਂਕਿ ਇਤਿਹਾਸ ਜਿਹੜਾ ਉਹ ਕਦੇ ਖ਼ਤਮ ਨਹੀਂ ਹੁੰਦਾ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਇਹ ਚੀਜ਼ਾਂ ਸਿੱਖਣ 'ਚ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਜੋ ਇਤਿਹਾਸ ਮੈਂ ਸਿੱਖਾਂ ਜੋ ਪੜ੍ਹਾਂ ਮੈਂ ਆਪਣੇ ਤਜਰਬੇ ਨੂੰ ਅਗਾਂਹਾ ਵੀ ਕਿਸੇ ਨਾਲ਼ ਸ਼ੇਅਰ ਕਰਾਂ ਕਿ ਇਤਿਹਾਸ ਹਮੇਸ਼ਾ ਆਪਣੀ ਥਾਪ ਛੱਡ ਕੇ ਜਾਂਦਾ ਹੈ